ਪੰਜਾਬ ਵਿੱਚ ਹੈਲਥ ਕੇਅਰ ਤੱਕ ਪਹੁੰਚਣ ਲਈ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦਾ ਕਾਰਨ ਇਹ ਹੈ ਕਿ ਇਸ ਵਿੱਚ ਹੋਸਪਿਟਲਾਂ ਦੀ ਕਮੀ ਡਿਸਟਰਿਕ ਵਿੱਚ ਹੋਸਪਿਟਲਾਂ ਵਿੱਚ ਬੈੱਡ ਦੀ ਕਮੀ ਡਾਕਟਰਾਂ ਦੀ ਕਮੀ ਦਵਾਈਆਂ ਦੀ ਘਾਟ ਪਿੰਡ ਤੋਂ ਹੋਸਪਿਟਲ ਦੀ ਦੂਰੀ ਜ਼ਿਆਦਾ ਲੋਕਾਂ ਦੀ ਸਮੱਸਿਆ ਦਾ ਕਾਰਨ ਹੈ ਲੋਕ ਕਈ ਵਾਰ ਪਰੇਸ਼ਾਨ ਹੋ ਜਾਂਦੇ ਨੇ ਅਤੇ ਆਪਣੀ ਜਾਨ ਵੀ ਗਵਾ ਦਿੰਦੇ ਨੇ ਡਾਕਟਰ ਕੋਲ ਦਵਾਈ ਦੀ ਕਮੀ ਹੋਣ ਕਾਰਨ ਪ੍ਰੋਪਰ ਇਲਾਜ ਨਾ ਹੋਣ ਕਾਰਨ ਛੋਟੇ ਡਿਸਟਰਿਕਾਂ ਵਿੱਚ ਪ੍ਰੋਪਰ ਦਵਾਈਆਂ ਦਾ ਅਰੇਂਜਮੈਂਟ ਨਾ ਹੋਣ ਕਾਰਨ ਉਹਨਾਂ ਦੁਆਰਾ ਰੈਫਰ ਕਰਨਾ ਰੈਫਰ ਕਰਨ ਦੂਸਰੇ ਵੱਡੇ ਸ਼ਹਿਰਾਂ ਵਿੱਚ ਦੌਰਾਨ ਰਸਤੇ ਵਿੱਚ ਹੀ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ ਇਸ ਨੂੰ ਸਹੀ ਕਰਨ ਲਈ ਪੰਜਾਬ ਸਰਕਾਰ ਨੂੰ ਹੈਲਥ ਡਿਪਾਰਟਮੈਂਟ ਵਿੱਚ ਬਹੁਤ ਜ਼ਿਆਦਾ ਠੀਕ ਕਰਨ ਦੀ ਲੋੜ ਹੈ ਡਾਕਟਰਾਂ ਦੀ ਭਰਤੀ ਕੀਤੀ ਜਾਵੇ ਬੈੱਡ ਜੋ ਉਹਨਾਂ ਦੀ ਸੰਖਿਆ ਵਧਾਈ ਜਾਵੇ ਮੈਡੀਸਨ ਪ੍ਰੋਪਰ ਵਰਤੋਂ ਵਿੱਚ ਲਈ ਜਾਵੇ ਡਾਕਟਰ ਦਵਾਈ ਵੀ ਪ੍ਰੋਪਰ ਤੌਰ 'ਤੇ ਹੋਸਪਿਟਲ ਵਿੱਚ ਹੋਣੀ ਚਾਹੀਦੀ ਹੈ ਕਈ ਵਾਰ ਤਾਂ ਜੋ ਡਾਕਟਰ ਮੈਡੀਸਨ ਲਿਖਦੇ ਨੇ ਉਹ ਹੋਸਪਿਟਲ ਵਿੱਚ ਹੁੰਦੀ ਹੀ ਨਹੀਂ ਆ ਅਤੇ ਮੈਡੀਕਲ ਸਟੋਰ ਬਾਹਰ ਜਾ ਕੇ ਗਰੀਬ ਲੋਕ ਆਪਣਾ ਪੈਸਾ ਵੀ ਲੁਟਾਉਂਦੇ ਨੇ ਇਸ ਨਾਲ ਪੰਜਾਬ ਵਿੱਚ ਹੈਲਥ ਡਿਪਾਰਟਮੈਂਟ ਵਿੱਚ ਸੁਧਾਰ ਕਰਨ ਦੀ ਬਹੁਤ ਬਹੁਤ ਜ਼ਰੂਰਤ ਹੈ